ਹੈਲੋ ਸਵੀਗੀ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਤੋਂ ਹਰ ਵਾਰ ਰੈਸਟੋਰੈਟ ਦੇ ਵਿਚ ਵਿੱਚ ਖਾਣਾ ਮੰਗਵਾਉਂਦੀ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਅੱਜ ਤੁਹਾਡੇ ਮੈਨਿਊ ਵਿੱਚ ਕੀ ਖ਼ਾਸ ਚੀਜ਼ ਹੈ ਕਿਉਂਕਿ ਅੱਜ ਸਾਡੇ ਘਰ ਵਿੱਚ ਖ਼ਾਸ ਦਿਨ ਹੈ ਅੱਜ ਮੇਰੀ ਬੇਟੀ ਦਾ ਜਨਮਦਿਨ ਹੈ ਇਸ ਕਰਕੇ ਅਸੀਂ ਕੁਝ ਅੱਜ ਖ਼ਾਸ ਖਾਣਾ ਚਾਹੁੰਦੇ ਹਾਂ ਤੁਹਾਡੇ ਰੈਸਟੋਰੈਂਟ ਵਿੱਚ ਅੱਜ ਕੀ ਨਵਾਂ ਕੁਝ ਬਣਿਆ ਹੈ ਜੇ ਕੁਝ ਬਣਿਆ ਹੈ ਤਾਂ ਮੈਨੂੰ ਉਸ ਦਾ ਮੈਨਿਊ ਸੈਂਡ ਕਰ ਦਿਓ ਕਿਉਂਕਿ ਮੈਂ ਤੁਹਾਡੇ ਰੈਸਟੋਰੈਚ ਵਿੱਚ ਪਹਿਲਾਂ ਵਾਲਾ ਸਾਰਾ ਖਾਣਾ ਖਾ ਚੁੱਕੀ ਹਾਂ ਅਤੇ ਅਸੀਂ ਹੁਣ ਕੁਝ ਨਵਾਂ ਖਾਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਇਟਾਲੀਅਨ ਫੂਡ ਜੇਕਰ ਤੁਸੀਂ ਇਟਾਲੀਅਨ ਫੂਡ ਤੁਹਾਡੇ ਕੋਲ ਹੈਗਾ ਤਾਂ ਮੈਨੂੰ ਦੱਸੋ ਜੇ ਨਹੀਂ ਤਾਂ ਮੈਨੂੰ ਕਿਰਪਾ ਕਰਕੇ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਜੇ ਦੇ ਸਕਦੇ ਹੋ ਤਾਂ ਮੈਨੂੰ ਇਸ ਔਡਰ ਨੂੰ ਜਲਦੀ ਤੋਂ ਜਲਦ ਮੇਰੇ ਘਰ ਭੇਜ ਦਿਓ ਤਾਂ ਜੋ ਅਸੀਂ ਫੂਡ ਦਾ ਆਨੰਦ ਮਾਣ ਸਕੀਏ ਸਾਡੇ ਘਰ ਵਿੱਚ ਸੱਤ ਜੀਅ ਹਨ ਉਹਨਾਂ ਸੱਤਾਂ ਜੀਆਂ ਵਾਸਤੇ ਇਟਾਲੀਅਨ ਫੂਡ ਤਿਆਰ ਕਰਕੇ ਭੇਜ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ